ਭਾਰ ਘਟਾਉਣ ਲਈ ਸਭ ਤੋਂ ਵਧੀਆ ਚੀਜ਼ ਹੈਗੀ ਕਸਰਤ ਕਰਨਾ ਕਸਰਤ ਨਾਲ਼ ਨਾ ਬੰਦੇ ਦੇ ਸਰੀਰ ਦੀ ਗਰਮੀ ਨਿਕਲਦੀ ਹੈ ਜਿਸ ਨਾਲ਼ ਆਪਣੇ ਸਰੀਰ ਦਾ ਫੈਟ ਮੱਚਦਾ ਹੈ ਇਸ ਨਾਲ਼ ਸਭ ਤੋਂ ਵੱਧ ਭਾਰ ਘੱਟਦਾ ਹੈ ਉਸ ਤੋਂ ਵੱਧ ਅਗਲੀ ਚੀਜ਼ ਆ ਜਾਂਦੀ ਹੈ ਖਾਣਾ ਪੀਣਾ ਖਾਣਾ ਪੀਣਾ ਆਪਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਸਾਨੂੰ ਤਲ਼ੀਆਂ ਹੋਈਆਂ ਚੀਜ਼ਾਂ ਘੱਟ ਖਾਣੀਆਂ ਚਾਹੀਦੀਆਂ ਹਨ ਮਿੱਠਾ ਘੱਟ ਖਾਣਾ ਚਾਹੀਦਾ ਹੈ ਜਿਸ ਨਾਲ਼ ਸਾਡਾ ਭਾਰ ਘੱਟ ਵੱਧੇ ਅਤੇ ਸਭ ਤੋਂ ਜ਼ਰੂਰੀ ਚੀਜ਼ ਹੈਗੀ ਮਿਹਨਤ ਕਰਨਾ ਜਿਸ ਨਾਲ਼ ਆਪਣੀ ਗਰਮੀ ਨਿਕਲ਼ ਸਕੇ